ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਅੰਮ੍ਰਿਤਸਰ ਵਿਜਿਟ ਕੀਤਾ ਤੇ ਮੇਰੀ ਇਥੇ ਫਰੈਂਡ ਮੈਨੂੰ ਘੁਮਾ ਲੈਣ ਈ ਲੈ ਕੇ ਗਈ ਸੀ ਕੱਲ ਮੈਂ ਜਲਿਆ ਵਾਲਾ ਬਾਗ ਦੇਖਿਆ ਤਦੋ ਮੇਰੀ ਫਰੈਂਡਸ ਤਾਂ ਫਰੈਂਡ ਤਾਂ ਮੈਨੂੰ ਕੁਝ ਜਿਆਦਾ ਦੱਸ ਨਹੀਂ ਦੱਸ ਸਕੀ ਤੇ ਤਦ ਉਹਨਾਂ ਨੇ ਮੈਨੂੰ ਤੁਹਾਡਾ ਅੱਗੋਂ ਨੰਬਰ ਦਿੱਤਾ ਕਿ ਤੁਸੀਂ ਇਸ ਹਿਸਟਰੀ ਬਾਰੇ ਚੰਗੀ ਤਰ੍ਹਾਂ ਜਾਣੂ ਓ ਸਰ ਮੈਨੂੰ ਤੁਸੀਂ ਜਿਲਿਆਵਾਲਾ ਬਾਗ ਬਾਰੇ ਕੁਝ ਦੱਸ ਸਕਦੇ ਓ ਕੀ ਜਲਿਆ ਵਾਲਾ ਬਾਗ ਦੀ ਕੀ ਘਟਨਾ ਹੋਈ ਇਹ ਕਿਸ ਤਰ੍ਹਾਂ ਹੋਇਆ ਕਿਸ ਟਾਈਮ ਦੀ ਇਹ ਘਟਨਾ ਉੱਥੇ ਜਿਆਦਾ ਜੀ ਰੋਲ ਐਕਟ ਇਹ ਅੱਛਾ ਜੀ ਠੀਕ ਜੀ

ਠੀਕ ਠੀਕ ਠੀਕ ਇਹ ਉਹ ਈ ਲੋਕ ਸੀ ਜੋ ਦਰਬਾਰ ਸਾਹਿਬ ਵੱਲ ਨੂੰ ਜਾਂਦੇ ਸੀ ਕਿਉਂਕੀ ਦਰਬਾਰ ਸਾਹਿਬ ਵੀ ਉਹਨਾਂ ਦੇ ਨਜਦੀਕ ਹੀ ਹਰਿਮੰਦਰ ਸਾਹਿਬ ਪੈਂਦਾ ਤਾਂ ਕਰਕੇ ਕਿ ਇਹ ਸਪੈਸ਼ਲ ਈ ਕੱਠੇ ਹੋਏ ਸੀ ਅੱਛਾ ਜੀ ਅੱਛਾ ਅੱਛਾ ਤੇ ਉਹਨਾਂ ਦਾ ਉੱਥੇ ਮੁੱਦਾ ਇਹੀ ਸੀ ਕੀ ਮਤਲਵ ਅਸੀਂ ਰੋਲ ਐਕਟ ਦੇ ਅਗੇਂਨਸਟ ਬੋਲ ਰਹੇ ਆ ਹੈਨਾ ਜੀ ਹਾਂ ਪਰ ਉੱਥੇ ਤਾਂ ਇੱਕੋ ਦਮ ਗੋਲੀਆਂ ਚਲ ਜਾਣੀਆ ਇਹ ਚੀਜ਼ ਕਿਸ ਤਰਾਂ ਪੋਸੀਬਲ ਹੋਈ ਸਰ ਓਥੇ ਮਤਲਵ ਕੋਣ ਸੀ ਜੋ ਉੱਤੇ ਇਸ ਚੀਜ਼ ਦੇ ਖਿਲਾਫ ਹੋ ਕੇ ਮਤਲਵ ਅੰਦਰ ਐਟਰ ਕੀਤਾ ਤੇ ਉਹਨੇ ਗੋਲੀਆਂ ਚਲਾ ਦਿੱਤੀਆਂ ਅੱਛਾ ਜੀ ਜੀ ਜੀ ਜੀ

ਹਾਂਜੀ ਹਾਂਜੀ ਓ ਸੋ ਸੈਡ ਉੱਥੇ ਓਹ ਖੂਹ ਵੀ ਮੈਂ ਦੇਖ ਕੇੇ ਆਈ ਓਹ ਖੂਹ ਬਹੁਤ ਜਿਆਦਾ ਡੂੰਘਾ ਐ ਤੇ ਉਹਦਾ ਕੀ ਇਤਿਹਾਸ ਐ ਸਰ ਉਸ ਜਗਾ ਤੇ

ਓ ਜੀ ਜੀ ਓਥੇ ਦ ਸਰ ਉਸ ਤੋਂ ਬਾਅਦ ਕੀ ਉਥੋਂ ਦੀ ਪਬਲਿਕ ਜਿਹੜੀ ਉਹਦੇ ਨਜ਼ਦੀਕ ਰਹਿੰਦੀ ਸੀ ਉਹਨਾਂ ਨੇ ਕੋਈ ਉਹਨਾਂ ਦੇ ਆਰਮੀ ਦੇ ਅਗੇਂਸਟ ਜਾਂ ਬ੍ਰਿਟਿਸ਼ਰ ਦੇ ਅਗੇਂਸਟ ਨਹੀਂ ਚੱਲੇ ਉਹ ਤਾਂ ਉਸ ਟਾਈਮ ਜਾਂ ਬ੍ਰਿਟਿਸ਼ ਗਵਰਮੈਂਟ ਜਿੰਨੇ ਉਸ ਜਗਾ ਤੇ ਹਮਲਾ ਕੀਤਾ ਸੀ ਉਹਨੂੰ ਕੋਈ ਸਜ਼ਾ ਜਾਂ ਕੁਛ ਨੀ ਹੋਇਆ ਇੰਨਾ ਵੱਡਾ ਹਾਦਸਾ ਹੋ ਗਿਆ

ਜੀ ਜੀ ਜੀ ਬਦਲਾ ਕਿਸਨੇ ਲਿਆ ਸੀ ਸਰ ਉਥੇ ਜੋ ਮੇਰਾ ਖਿਆਲ ਉਥੇ ਜੋ ਇੱਕ ਸਟੈਚੂ ਖੜਾ ਸ਼ਾਇਦ ਉਹਨਾਂ ਦਾ ਨਾਮ ਮੈਨੂੰ ਨਹੀਂ ਯਾਦ ਬਦਲਾ ਕਿਸਨੇ ਲਿਆ ਸੀ ਸਰ ਉਧਮ ਸਿੰਘ ਕੁਝ ਇਦਾਂ ਕਰਕੇ ਲਿਖਿਆ ਹਾਂਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਠੀਕ ਠੀਕ ਇਸ ਤੋਂ ਇਲਾਵਾ ਸਰ ਹੋਰ ਜਲਿਆ ਵਾਲਾ ਬਾਗ ਦੇ ਵਿੱਚ ਮਤਲਬ ਕੋਈ ਲੋਕ ਬਚੇ ਵੀ ਜਾਂ ਉੱਤੇ ਕੋਈ ਸੰਸਥਾ ਜਾਂ ਪਹੁੰਚ ਕੇ ਉਹਨਾਂ ਨੂੰ ਬਚਾ ਨਹੀਂ ਪਾਈ ਕੁਛ ਵੀ ਕੁਝ ਕੁ ਲੋਕ ਤਾਂ ਬਚੇ ਹੀ ਹੋਣਗੇ ਚਲੋ ਠੀਕ ਹ ਸਰ ਥੈਂਕਯੂ ਤੁਸੀਂ ਇਨੀ ਇਨਫੋਰਮੇਸ਼ਨ ਦਿੱਤੀ ਥੈਂਕ ਯੂ ਸੋ ਮੱਚ ਸਰ ਥੈਂਕਯੂ ਜੀ